ਪਸ਼ੂ ਜਿਹੜੇ ਅਸੀਂ ਰੱਖੇ ਦੇ ਨੇ ਉਨ੍ਹਾਂ ਦੀ ਸਾਨੂੰ ਬੜੀ ਜਿੰਮੇਵਾਰੀ ਹੈ ਅਸੀਂ ਉਨ੍ਹਾਂ ਦਾ ਬੜਾ ਧ ਧਿਆਨ ਰੱਖਦੇ ਹਾਂ ਬੜੀ ਖਾਣੇ ਪੀਣੇ ਵਾਸਤੇ ਖਰਚਾ ਲਾ ਦਿੰਦੇ ਹਾਂ ਹੈਂਜੀ

ਸੇਵਾ ਅਸੀਂ ਬਹੁਤ ਕਰਦੇ ਹਾਂ ਉਹਨਾਂ ਦੀ ਤਾਹੀਂ ਤਾਂ ਸਾਡਾ ਗੁਜਾਰਾ ਹੋਇਆ ਕਰਦਾ ਹੈ

ਅਸੀਂ ਚਾਰਾ ਪਾਉਂਦੇ ਹਾਂ ਖਾਦ ਪਾਉਂਦੇ ਹਾਂ ਸਭ ਕੁਛ ਪਾਉਂਦੇ ਹਾਂ ਉਹਨਾਂ ਨੂੰ ਅਸੀਂ ਹਾਂਜੀ